ਸਤਿ ਸ਼੍ਰੀ ਅਕਾਲ ਜੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਵਿੱਚ ਨੂੰ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਸ ਲਈ ਜਿਵੇਂ ਕਿ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਅਤੇ ਸਾਡੀ ਜੇਬ 'ਚ ਵੀ ਥੋੜ੍ਹਾ ਨੁਕਸਾਨ ਹੋਇਆ ਹੈ ਜੇਬ ਅਤੇ ਸਾਨੂੰ ਬਹੁਤ ਜ਼ਿਆਦਾ ਨਜਾਇਜ਼ ਖਰਚੇ ਕਰਨੇ ਪੈਂਦੇ ਹਨ ਅਤੇ ਜਦੋਂ ਕਿ ਬਾਲਣ ਦੀ ਵਰਤੋਂ ਵਾਤਾਵਰਨ ਲਈ ਨੁਕਸਾਨ ਦੇਣ ਦੀ ਗੱਲ ਹੈ ਅਤੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪ੍ਰਦੂਸ਼ਣ ਫੈਲਦਾ ਹੈ ਇਸ ਲਈ ਰੁੱਖਾਂ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਕਿ ਪ੍ਰਦੂਸ਼ਣ ਨਾਲ ਆਪਣੇ ਆਪਾਂ ਨੂੰ ਵੀ ਸਾਹ 'ਚ ਨੁਕਸਾਨ ਹੁੰਦਾ ਹੈ ਜਦੋਂ ਆਪਾਂ ਕਿ ਸਾਹ ਲੈਣ 'ਚ ਦਿੱਕਤ ਮਿਲਦੀ ਹੈ ਆਪਾਂ ਨੂੰ ਅਤੇ ਵਾਤਾਵਰਨ ਤਾਂ ਪ੍ਰਦੂਸ਼ਣ ਹੁੰਦਾ ਹੀ ਹੁੰਦਾ ਵਾਤਾਵਰਨ ਪ੍ਰਦੂਸ਼ਣ ਹੋਣ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਵੀ ਲੱਗਦੀਆਂ ਹਨ ਅਤੇ ਇਸ ਲਈ ਸਾਨੂੰ ਪੈਟਰੋਲ ਦੀਆਂ ਕੀਮਤਾਂ 'ਚ ਜਦੋਂ ਵਾਧਾ ਹੁੰਦਾ ਹੈ ਆਪਾਂ ਨੂੰ ਵੀ ਫਰਕ ਪੈਂਦਾ ਹੈ ਇਸ ਲਈ ਜਦੋਂ ਵਾਤਾਵਰਨ ਖਰਾਬ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਵੀ ਲੱਗਦੀਆਂ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਤਾਂ ਉਹਨਾਂ ਨੂੰ ਪ੍ਰਭਾਵਿਤ ਵੀ ਕਰਦਾ ਹੈ ਕਿਉਂਕਿ ਜਦੋਂ ਆਪਾਂ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਆਪਾਂ ਨੂੰ ਵੀ ਕੁਝ ਨਾ ਕੁਝ ਖਰਚੇ ਵਧਦੇ ਹਨ ਆਪਣੇ ਵੀ ਇਸ ਕਰਕੇ ਜਦੋਂ ਆਪਣੀਆਂ ਕੀਮਤਾਂ ਵਧਦੀਆਂ ਹਨ ਅਤੇ ਖਰਚੇ ਵੀ ਵਧਦੇ ਹਨ ਇਸ ਕਰਕੇ ਆਪਣੀ ਜੇਬ 'ਚ ਵੀ ਘਾਟਾ ਪੈਂਦਾ ਹੈ